ਹਾਂਜੀ ਮੈਂ ਐਮਾਜ਼ੋਨ ਤੋਂ ਇੱਕ ਸੋਫ਼ਾ ਆਰਡਰ ਕੀਤਾ ਸੀ ਜੋ ਕਿ ਬਹੁਤ ਵਧੀਆ ਨਿਕਲਿਆ ਔਰ ਘਰਦਿਆਂ ਨੂੰ ਵੀ ਪਸੰਦ ਆਇਆ ਔਰ ਲੇਟੋ ਨੂੰ ਪਸੰਦ ਵਾਇਆ ਪਸੰਦ ਆਇਆ ਔਰ ਮੈਨੂੰ ਉਸਦੇ ਉੱਪਰ ਪੈਣਾ ਬੈਠਣਾ ਉੱਠਣਾ ਬਹੁਤ ਵਧੀਆ ਲੱਗਦਾ ਹੈ ਥੈਂਕ ਊ